ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਠੀਕ ਹੈ ਜੀ ਕੱਦ ਤੱਕ ਚਾਹੀਦਾ ਜੀ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਨੌਰਮਲ ਸੂਟ ਦਾ ਤਾਂ ਤਿੰਨ ਸੌ ਹੈ ਜੀ ਜੇ ਮਤਲਬ ਕੀ ਸਿੰਪਲ ਬਿਲਕੁੱਲ ਹੀ ਸਿੰਪਲ ਜੇ ਤੁਸੀਂ ਉਹਦੇ ਉੱਤੇ ਸੁਆਣਾ ਏ ਗਾਵੀ ਮਤਲਬ ਕਿ ਤਿਆਰ ਪੂਰਾ ਕਰਵਉਣਾ ਹੈ ਲੈਸ ਵਗੈਰਾ ਲਾ ਕੇ ਲਾਈਨਿੰਗ ਲਾ ਕੇ ਤਾਂ ਉਹ ਅੱਠ ਸੌ ਰੁਪਏ ਹੈ ਜੀ ਜੇ ਤੁਸੀਂ ਉਹਦੇ ਵੀ ਉੱਤੇ ਚਾਹੁੰਦੇ ਐਂਗੇ ਵੀ ਹੋਰ ਵੀ ਹੋਵੇ ਪਾਲ਼ਟੀ ਵੀਅਰ ਵਗੈਰਾ ਤਿਆਰ ਕਰਨਾ ਹੈ ਤਾਂ ਉਹਦੀ ਸਿਲਾਈ ਪੰਦਰਾਂ ਸੌ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਟਾਈਮ ਸਿਰ ਮਿਲੂਗਾ ਜੇ ਤੁਸੀਂ ਮਤਲਬ ਕੀ ਜਿੰਨੀ ਜ਼ਲਦੀ ਆਊਗੇ ਦੇਣ ਹੈ ਨਾ ਉਹਨੀ ਜ਼ਲਦੀ ਹੀ ਤਿਆਰ ਹੋਜੂਗਾ ਠੀਕ ਹੈ ਜੀ ਬਣਜੂਗੀ ਜੀ ਕੋਈ ਨਾ ਤਾਂ ਤੁਸੀਂ ਕੱਪੜਾ ਮਤਲਬ ਕੀ ਆਪਣਾ ਵੀ ਜੇ ਪਟਿਆਲਾ ਸ਼ਾਹੀ ਕਰਵਾਉਣੀ ਤਾਂ ਕੱਪੜਾ ਜ਼ਿਆਦਾ ਹੀ ਲੈ ਕੇ ਵੈਸੇ ਤਾਂ ਪੰਜ ਹੁੰਦਾ ਉਹਦੇ ਕਰਕੇ ਜ਼ਿਆਦਾ ਹਾਂਜੀ ਸੱਤ ਵਜ਼ੇ ਤੱਕ ਜੀ ਹਾਂਜੀ ਜੀ ਓਕੇ ਜੀ ਓਕੇ ਠੀਕ ਹੈ ਜੀ ਆ ਜੇਓ ਠੀਕ ਹੈ ਓਕੇ